ਪਾਣੀ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਤੱਤ ਹੈ ਇੱਕ ਇਨਸਾਨ ਖਾਣੇ ਬਿਨਾਂ ਜ਼ਰੂਰ ਰਹਿ ਸਕਦਾ ਲੇਕਿਨ ਪਾਣੀ ਬਿਨਾਂ ਨਹੀਂ ਰਹਿ ਸਕਦਾ ਪਾਣੀ ਦੇ ਬਹੁਤ ਸਾਰੀ ਮਹੱਤਤਾ ਹੈ ਸਾਡੇ ਸਰੀਰ ਦੇ ਵਿੱਚ ਇੱਕ ਤਾਂ ਇਹ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦਾ ਹੈ ਦੂਸਰਾ ਇਸ ਨਾਲ ਸਾਡੇ ਸਰੀਰ ਦੀ ਨਮੀ ਬਣੀ ਰਹਿੰਦੀ ਹੈ ਜਿਸ ਨੂੰ ਅਸੀਂ ਹਾਈਡਰੇਸ਼ਨ ਕਹਿੰਦੇ ਹਾਂ ਅਤੇ ਸਾਡੀ ਬਾਡੀ ਵੀ ਜਿਹੜੀ ਸਹੀ ਰਹਿੰਦੀ ਹੈ ਜੇ ਪਾਣੀ ਦੀ ਕਮੀ ਹੋ ਜਾਵੇ ਤਾਂ ਉਸ ਨਾਲ ਕੀ ਹੁੰਦਾ ਬੁੱਲ ਸੁਕਣੇ ਸ਼ੁਰੂ ਹੋ ਜਾਂਦੇ ਆ ਬਾਥਰੂਮ ਵੀ ਜਿਹੜਾ ਹੈ ਉਹ ਘੱਟ ਆਉਂਦਾ ਹੈ ਠੀਕ ਹੈ ਸਹੀ ਤਰੀਕੇ ਨਾਲ ਬਾਥਰੂਮ ਨਹੀਂ ਆਉਂਦਾ ਅਤੇ ਉਸਨੂੰ ਕੁਛ ਇਨਸਾਨ ਨੂੰ ਉਸਨੂੰ ਇਨਸਾਨ ਨੂੰ ਬਹੁਤ ਸਾਰੀ ਤਕਲੀਫ ਹੋਣੀ ਉਸਨੂੰ ਬਹੁਤ ਸਾਰੀ ਤਕਲੀਫਾਂ ਹੋ ਮਤਲਬ ਪ੍ਰੋਬਲਮਾਂ ਹੋ ਸਕਦੀਆਂ ਜੇ ਪਾਣੀ ਨਾ ਪੀਵੇ ਤਾਂ ਉਸ ਨਾਲ ਬਹੁਤ ਸਾਰੀ ਦਿੱਕਤ ਆ ਸਕਦੀ ਹੈ ਜਿਵੇਂ ਗੁਰਦੇ ਘੱਟ ਕੰਮ ਕਰਨੇ ਸ਼ੁਰੂ ਕਰ ਸਕਦੇ ਹਨ ਠੀਕ ਹੈ ਬੀ ਪੀ ਦੀ ਪ੍ਰੋਬਲਮ ਹੋ ਸਕਦੀ ਹੈ ਠੀਕ ਹੈ ਉਸ ਤੋਂ ਇਲਾਵਾ ਜਿਹੜਾ ਆਪਣਾ ਹਾਈਪੋਗਲਾਸੀਮੀਆ ਜਦੋਂ ਹੋ ਜਾਂਦਾ ਉਸ ਤੋਂ ਵੀ ਆਪਾਂ ਜਦੋਂ ਪਾਣੀ ਨਾ ਦੇਈਏ ਤਾਂ ਉਸ ਤੋਂ ਵੀ ਦਿੱਕਤ ਹੋ ਜਾਂਦੀ ਹੈ ਕਿਉਂਕਿ ਪਾਣੀ ਜ਼ਰੂਰੀ ਹੈ ਜਿਹੜਾ ਕਿ ਸਾਡੇ ਸਰੀਰ ਨੂੰ ਕੀ ਕਰਦਾ ਮੈਨਟੇਨ ਕਰਕੇ ਰੱਖਦਾ ਜੇ ਅਸੀਂ ਪਾਣੀ ਨਹੀਂ ਪੀਵਾਂਗੇ ਸਾਰਾ ਦਿਨ ਤਾਂ ਸਾਡੀ ਜਿਹੜਾ ਸਰੀਰ ਆ ਉਹ ਕੀ ਕਰੂਗਾ ਮਤਲਬ ਕਿ ਨਮੀ ਹੋ ਜਾਵੇਗੀ ਅਤੇ ਨਮੀ ਦੀ ਕਮੀ ਹੋ ਜਾਵੇਗੀ ਜਿਸਨੂੰ ਆਪਾਂ ਡੀਹਾਈਡਰੇਸ਼ਨ ਕਹਿੰਦੇ ਹਾਂ ਡੀਹਾਈਡਰੇਸ਼ਨ ਹੋਣ ਨਾਲ ਕੀ ਹੁੰਦਾ ਜਿਹੜਾ ਇਨਸਾਨ ਆ ਉਹ ਸੁੱਕਦਾ ਅਤੇ ਮੁਰਝਾਏ ਹੋਏ ਸਰੀਰ ਲੱਗਦਾ ਹੈ ਅਗਰ ਪਾਣੀ ਰੋਜ਼ ਵਰਤੋਂ ਕਰਦਾ ਤਾਂ ਉਸ ਨਾਲ ਕੀ ਹੁੰਦਾ ਕਿ ਇੱਕ ਤਾਂ ਉਸਦੀ ਬਾਡੀ ਦੀ ਨਮੀ ਬਣੀ ਰਹਿੰਦੀ ਹੈ ਅਤੇ ਉਸਦੇ ਜਿਹੜੇ ਅੰਗ ਆ ਉਹ ਵੀ ਸਹੀ ਤਰੀਕੇ ਨਾਲ ਕੰਮ ਕਰਦੇ ਹਨ ਤੇ ਖਾਣਾ ਵੀ ਪਚਾਉਣ 'ਚ ਹੈਲਪ ਮਦਦ ਕਰਦਾ ਇਹ ਠੀਕ ਹੈ ਪਾਣੀ ਦੀ ਬਹੁਤ ਜ਼ਿਆਦਾ ਮਹੱਤਤਾ ਹੈ ਠੀਕ ਹੈ ਬਿਨਾਂ ਪਾਣੀ ਇਨਸਾਨ ਨਹੀਂ ਰਹਿ ਸਕਦਾ ਜੇ ਹੁਣ ਆਪਾਂ ਵਿਚਾਰ ਕਰੀਏ ਕਿ ਇੱਕ ਦਿਨ ਪੂਰਾ ਇੱਕ ਇਨਸਾਨ ਪਾਣੀ ਨਾ ਪੀਵੇ ਤਾਂ ਉਸਨੂੰ ਕੀ ਹੋ ਸਕਦਾ ਕਿ ਉਸਨੂੰ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਸਕਦੀਆਂ ਹਨ ਜਿਹੜੇ ਪੇਟ ਦੀ ਪ੍ਰੋਬਲਮ ਹੋ ਸਕਦੀ ਹੈ ਕਬਜ਼ ਬਣੀ ਰਹਿ ਸਕਦੀ ਹੁਣ ਜਦੋਂ ਕਬਜ਼ ਬਣਦੀ ਹੈ ਅਤੇ ਉਸਤੋਂ ਜਦੋਂ ਕੀ ਕਹਿੰਦੇ ਹਾਂ ਅਸੀਂ ਪਾਣੀ ਪੀਣ ਨੂੰ ਕਹਿੰਦੇ ਹਾਂ ਕਿ ਤਾਂ ਜੋ ਜਿਹੜਾ ਇਨਸਾਨ ਆ ਉਹਨੂੰ ਕੀ ਹੋ ਸਕੇ ਉਹਦਾ ਜਿਹੜਾ ਸਟੂਲ ਆ ਉਹ ਈਜਲੀ ਪਾਸ ਆਊਟ ਹੋ ਸਕੇ ਲੇਕਿਨ ਹੁਣ ਜੇ ਉਹ ਪਾਣੀ ਨਹੀਂ ਪੀਵੇਗਾ ਅਤੇ ਉਸ ਨਾਲ ਕੀ ਹੋ ਜਾਂਦਾ ਹੈ ਕਿ ਮਤਲਬ ਕਿ ਜਿਹੜੀ ਕੋਸਟੀਪੇਸ਼ਨ ਦੀ ਪ੍ਰੋਬਲਮ ਜ਼ਿਆਦਾ ਹੋ ਜਾਂਦੀ ਹੈ ਠੀਕ ਹੈ ਵੈਸੇ ਤਾਂ ਸਲਾਦ ਵਗੈਰਾ ਖਾਣਾ ਫਾਈਬਰ ਰਿੱਚ ਡਾਈਟ ਹੋਣੀ ਚਾਹੀਦੀ ਹੈ ਪਰ ਪਾਣੀ ਵੀ ਬਹੁਤ ਮਹੱਤਤਾ ਰੱਖਦਾ ਹੈ ਸਾਡੇ ਪੇਟ ਦੇ ਲਈ ਠੀਕ ਆ ਪੇਟ ਨੂੰ ਸਾਫ਼ ਕਰਨ ਦੀ ਇਹ ਵੀ ਬਹੁਤ ਮਹੱਤਤਾ ਹੈ ਜ਼ਹਰੀਲੇ ਪਦਾਰਥ ਜਦੋਂ ਆਪਾਂ ਖਾ ਲਈਏ ਹੁਣ ਜਾਏ ਪਰ ਅਸੀਂ ਦਵਾਈ ਖਾਣੀ ਹੋਵੇ ਕੁਛ ਮਿਰਚ ਜ਼ਿਆਦਾ ਲੱਗੀ ਹੋਵੇ ਕੁਛ ਆਪਾਂ ਤਿੱਖੇ ਚੀਜ਼ਾਂ ਆਪਾਂ ਖਾ ਜਾਂਦੇ ਹਾਂ ਸਾਨੂੰ ਇੱਕਦਮ ਸਾਡੇ ਸਰੀਰ ਕੀ ਕਰਦਾ ਪਾਣੀ ਮੰਗਦਾ ਜੇ ਹੁਣ ਮੰਨ ਲਓ ਅਸੀਂ ਕੋਈ ਚੀਜ਼ ਉੱਦਾਂ ਦੀ ਖਾ ਲਈਏ ਤਾਂ ਫਿਰ ਤੁਹਾਨੂੰ ਪਾਣੀ ਨਾ ਮਿਲੇ ਤਾਂ ਉਸ ਨਾਲ ਕੀ ਹੋ ਜਾਂਦਾ ਹੈ ਕਿ ਜਿਹੜਾ ਸਾਡਾ ਸਰੀਰ ਆ ਉਸਨੂੰ ਮਤਲਬ ਦਿੱਕਤ ਆਉਣੀ ਸ਼ੁਰੂ ਹੋ ਜਾਂਦੀ ਐ ਅਸੀਂ ਕੀ ਆ ਸਾਰਾ ਦਿਨ ਹੁਣ ਆਪਾਂ ਜੇ ਪਾਣੀ ਨਾ ਪੀਈਏ ਹੁਣ ਆਪਾਂ ਮਿਰਚਾਂ ਖਾ ਲਈਆ ਸਾਡੀ ਜਿਹੜੀ ਟੇਸਟ ਬਟਸ ਹੁੰਦੇ ਹਨ ਠੀਕ ਆ ਉਹ ਮਤਲਬ ਕੀ ਕਰਦੇ ਹਨ ਉਸ ਚੀਜ਼ ਨੂੰ ਫਿਰ ਟੋਲਰੇਟ ਨਹੀਂ ਕਰ ਪਾਉਂਦੇ ਹੁਣ ਇਸ ਕਰਕੇ ਪਾਣੀ ਦੀ ਬਹੁਤ ਜ਼ਿਆਦਾ ਮਹੱਤਤਾ ਹੈ ਠੀਕ ਆ ਪਾਣੀ ਦੀ ਕਮੀ ਨਾਲ ਕਈ ਵਾਰ ਹੁੰਦਾ ਛਾਲੇ ਵੀ ਹੋ ਸਕਦੇ ਹਨ ਪੇਟ ਦੇ ਵਿੱਚ ਵੀ ਅਤੇ ਮੂੰਹ ਦੇ ਵਿੱਚ ਵੀ ਜ਼ਿਆਦਾਤਰ ਮੂੰਹ ਦੇ ਵਿੱਚ ਛਾਲੇ ਹੋ ਜਾਦੇ ਹਨ ਵੈਸੇ ਵਿਟਾਮਿਨ ਬੀ ਵੰਨ ਦੀ ਕਮੀ ਨਾਲ ਹੁੰਦੇ ਆ ਬਟ ਜੇ ਪਾਣੀ ਨਾ ਪੀਈਏ ਤਾਂ ਪਾਣੀ ਦੀ ਕਮੀ ਨਾਲ ਵੀ ਸ਼ਾਲੇ ਹੋ ਜਾਂਦੇ ਹਨ ਫਿਰ ਕੀ ਹੁੰਦਾ ਕਿ ਮੂੰਹ 'ਚ ਦਰਦ ਹੁੰਦੀ ਹੈ ਗੰਦੀ ਸਮੈਲ ਆਉਂਦੀ ਹੈ ਗੰਦੀ ਬਦਬੂ ਆਉਂਦੀ ਹੈ ਹੋਰ ਵੀ ਪਾਣੀ ਦੀ ਬਹੁਤ ਮਹੱਤਤਾ ਹੈ ਕਿ ਪਾਣੀ ਅਸੀਂ ਘਰ ਦੇ ਕੰਮਾਂ ਲਈ ਵਰਤਦੇ ਹਾਂ ਸਫਾਈ ਲਈ ਵਰਤਦੇ ਹਾਂ ਇਸ ਨੂੰ ਠੀਕ ਹੈ ਘਰ ਨੂੰ ਸਾਫ਼ ਰੱਖਣ ਦੇ ਲਈ ਹੁਣ ਆਪਾਂ ਪਾਣੀ ਦੀ ਇੱਕ ਦਿਨ ਪੂਰੇ ਦਿਨ ਨਾ ਵਰਤੋਂ ਕੀਤੀ ਜਾਵੇ ਨਾ ਤਾਂ ਅਸੀਂ ਨਹਾ ਪਾਵਾਂਗੇ ਨਾ ਤਾਂ ਅਸੀਂ ਪਾਣੀ ਪੀ ਪਾਵਾਂਗੇ ਨਾ ਅਸੀਂ ਸਫਾਈ ਰੱਖ ਪਾਵਾਂਗੇ ਤਾਂ ਹਰ ਇੱਕ ਚੀਜ਼ ਦੇ ਵਿੱਚ ਕਿੰਨਾ ਨੁਕਸਾਨ ਹੋ ਸਕਦਾ ਹੈ ਪਾਣੀ ਦੀ ਕਮੀ ਦੇ ਨਾਲ ਇਹ ਸਾਨੂੰ ਦਿਖ ਰਿਹਾ ਹੈ ਠੀਕ ਹੈ ਹਮ ਇਸ ਲਈ ਪਾਣੀ ਬਹੁਤ ਜ਼ਰੂਰੀ ਹੈ ਠੀਕ ਹੈ ਪਾਣੀ ਸਾਨੂੰ ਪੀਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਸਾਡੇ ਸਰੀਰ ਲਈ ਪਾਣੀ ਦੀ ਬਹੁਤ ਜ਼ਿਆਦਾ ਮਹੱਤਤਾ ਹੈ ਦਿਨ ਦੇ ਟਾਈਮ 'ਚ ਸਭ ਤੋਂ ਜ਼ਿਆਦਾ ਠੀਕ ਹੈ ਅਤੇ ਦੂਸਰੀ ਗੱਲ ਇਹ ਜਿਹੜਾ ਪਾਣੀ ਹੈ ਵੈਸੇ ਤਾਂ ਉਹ ਸਾਨੂੰ ਪੂਰੇ ਦਿਨ 'ਚ ਛੇ ਤੋਂ ਅੱਠ ਗਲਾਸ ਪੀਣਾ ਚਾਹੀਦਾ ਹੈ ਠੀਕ ਹੈ ਇਸ ਤੋਂ ਘੱਟ ਪੀਂਦੇ ਹਾਂ ਤਾਂ ਕੀ ਹੁੰਦਾ ਕਿ ਸਾਨੂੰ ਜਿਹੜੀ ਸਰੀਰ ਆ ਉਹਨੂੰ ਨਮੀ ਦੀ ਕਮੀ ਹੋ ਜਾਂਦੀ ਹੈ ਠੀਕ ਹੈ ਅਤੇ ਬੰਦਾ ਉਹ ਸੇਮ ਉਹ ਹੀ ਗੱਲ ਮੁਰਝਾਇਆ ਹੋਇਆ ਲੱਗਦਾ ਹੈ ਹੁਣ ਜਿਹੜਾ ਬੰਦਾ ਪਾਣੀ ਪੀਂਦਾ ਛੇ ਤੋਂ ਅੱਠ ਗਲਾਸ ਰੋਜ਼ ਪੀਂਦਾ ਅਤੇ ਉਸ ਨਾਲ ਕੀ ਹੋਵੇਗਾ ਇੱਕ ਤਾਂ ਉਹਦੀ ਸਿਹਤ ਬਣੀ ਰਹੇਗੀ ਇੱਕ ਉਹ ਥੋੜ੍ਹਾ ਐਕਟਿਵ ਵੀ ਨਜ਼ਰ ਆਉਂਦਾ ਉਹਦੀ ਸਕਿਨ ਵੀ ਜਿਹੜੀ ਹੁੰਦੀ ਉਹਦੇ ਜਿਹੜੇ ਸੈਲ ਹੁੰਦੇ ਉਹ ਵੀ ਕੀ ਹੁੰਦੇ ਐਕਟੀਵੇਟ ਹੋ ਜਾਂਦੇ ਆ ਠੀਕ ਹੈ ਡੈਡ ਨਹੀਂ ਹੁੰਦੇ ਅਤੇ ਜਿਹੜੀ ਬਾਡੀ ਵੀ ਉਹ ਫਰੈਸ਼ ਨਜ਼ਰ ਆਉਂਦੀ ਹੈ ਠੀਕ ਹੈ ਉਹ ਵੀ ਮੋਇਸਰਾਇਜ ਹੋ ਜਾਂਦੀ ਹੈ ਬਾਡੀ ਵੀ ਠੀਕ ਹੈ ਡੀਹੈਡਰੇਸ਼ਨ ਨਹੀਂ ਹੁੰਦੀ ਦੂਸਰੀ ਗੱਲ ਇਹ ਇਲੈਕਟੋਰੇਟ ਜਿਹੜੇ ਸਾਡੇ ਬਾਡੀ 'ਚ ਹੁੰਦੇ ਨੇ ਉਹਨਾਂ ਨੂੰ ਕੀ ਕਰਦਾ ਬੈਂਲਸ ਕਰਦਾ ਠੀਕ ਆ ਜਿਹਦਾ ਵਗੈਰਾ ਹਰ ਇੱਕ ਚੀਜ਼ ਹਰ ਇੱਕ ਚੀਜ਼ ਲਈ ਪਾਣੀ ਬਹੁਤ ਜ਼ਰੂਰੀ ਹੈ ਠੀਕ ਹੈ ਅਤੇ ਅਗਰ ਕੋਈ ਜ਼ਖਮ ਵਗੈਰਾ ਆਣ ਸਰੀਰ ਦੇ ਵਿੱਚ ਕੋਈ ਵੀ ਛਾਲੇ ਵਗੈਰਾ ਹੋਏ ਹੋਣ ਉਹਦੇ 'ਚ ਵੀ ਪਾਣੀ ਦਾ ਬਹੁਤ ਜ਼ਿਆਦਾ ਰੋਲ ਹੈ ਠੀਕ ਹੈ ਅਤੇ ਦੂਸਰੀ ਗੱਲ ਜਿਵੇਂ ਕਿ ਆਪਾਂ ਨਿੰਬੂ ਪਾਣੀ ਪੀਂਦੇ ਹਾਂ ਉਹ ਵੀ ਸਾਡੇ ਸਰੀਰ ਲਈ ਕੀ ਕਰਦਾ ਬਹੁਤ ਜ਼ਿਆਦਾ ਜ਼ਰੂਰੀ ਹੈ ਇੱਕ ਸਾਨੂੰ ਵਾਈਟਮੀਨ ਸੀ ਮਿਲਦਾ ਹੈ ਦੂਸਰੀ ਗੱਲ ਉਹਦੇ ਨਾਲ ਕੀ ਹੁੰਦਾ ਸਾਡੇ ਕਿ ਮਤਲਬ ਕਿ ਭੁੱਖ ਵੀ ਲੱਗਦੀ ਆ ਜਿਹਦੇ ਨਾਲ ਸਾਡਾ ਐਪੇਟਾਈਟਰ ਜਿਹੜਾ ਐਪੇਟਾਈਜ਼ਰ ਹੁੰਦਾ ਇੰਨਕਰੀਜ ਹੋ ਜਾਂਦਾ ਹੈ ਠੀਕ ਹੈ ਇਸ ਲਈ ਸਾਨੂੰ ਇਸਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਇਸ ਲਈ ਪਾਣੀ ਸਾਡੇ ਲਈ ਬਹੁਤ ਕੀਮਤੀ ਹੈ ਪਾਣੀ ਦੇ ਬਿਨਾਂ ਕੀ ਆ ਜੀਵ ਵੀ ਅਧੂਰੇ ਹਨ ਠੀਕ ਹੈ ਜੀਵ ਨੂੰ ਵੀ ਪਾਣੀ ਦੀ ਜਿਹੜੇ ਜਾਨਵਰ ਆ ਉਹਨਾਂ ਨੂੰ ਵੀ ਲੋੜ ਹੁੰਦੀ ਹੈ ਪਾਣੀ ਦੀ ਠੀਕ ਹੈ ਉਹਨਾਂ ਨੂੰ ਵੀ ਪਿਆਸ ਲੱਗਦੀ ਹੈ ਹੁਣ ਕੋਈ ਵੀ ਆਪਾਂ ਦੇਖ ਲਈਏ ਕੋਈ ਚਿੜੀਆ ਵਗੈਰਾ ਦੇਖ ਲਈਏ ਅਗਰ ਉਹ ਪਾਣੀ ਨਾ ਪੀਣ ਤਾਂ ਉਹ ਵੀ ਉਹ ਹੋ ਜਾਂਦੇ ਹਨ ਠੀਕ ਹੈ ਇਸ ਕਰਕੇ ਸਾਨੂੰ ਪਾਣੀ ਰੱਖਣਾ ਚਾਹੀਦਾ ਆਪਣੇ ਘਰਾਂ ਦੇ ਬਾਹਰ ਵੀ ਹਰ ਇੱਕ ਤਰ੍ਹਾਂ ਜੋ ਹਰ ਇਨਸਾਨ ਪਾਣੀ ਪੀ ਸਕੇ ਠੀਕ ਹੈ ਜਾਨਵਰ ਵੀ ਪੀ ਸਕਣ ਕਿ ਤਾਂ ਜੋ ਸਾਰੇ ਆਪਣੀ ਉਸਦੀ ਮਹੱਤਤਾ ਸਮਝਣ ਹੁਣ ਪਾਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਠੀਕ ਹੈ ਇਸਨੂੰ ਵੇਸਟ ਨਹੀਂ ਕਰਨਾ ਚਾਹੀਦਾ ਮਤਲਬ ਕਿ ਜਿੰਨਾ ਆਪਾਂ ਸਫਾਈਆਂ 'ਤੇ ਡੋਲ ਦਿੰਦੇ ਹਾਂ ਜਾਂ ਜੋ ਵੀ ਕਰਦੇ ਹਾਂ ਥੋੜ੍ਹਾ ਘੱਟ ਵਰਤੋਂ ਕਰਨੀ ਚਾਹੀਦੀ ਪਾਣੀ ਵਰਤਣਾ ਚਾਹੀਦਾ ਪਰ ਇੱਕ ਸਹੀ ਤਰੀਕੇ ਨਾਲ ਵਰਤਣਾ ਚਾਹੀਦਾ ਇਸ ਨੂੰ